ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਭੈਣ ਜੀ ਠੀਕ ਠਾਕ ਬਸ ਕੁਛ ਨਹੀਂ ਤੁਸੀਂ ਸੁਣਾਓ ਕਿਵੇਂ ਫੋਨ ਕੀਤਾ ਆਪਣੇ ਏਰੀਏ ਦੇ ਵਿੱਚ ਨੇੜੇ ਸਕੂਲ ਤਾਂ ਜਿਵੇਂ ਕਲਗੀਧਰ ਵੀ ਬੈਸਟ ਹੈ ਲਿਟਲ ਫਲਾਵਰ ਦੂਨ ਔਰ ਆਰਮੀ ਸਕੂਲ ਵੀ ਵਧੀਆ ਪਰ ਜਿਹੜੇ ਆਪਣੇ ਬੱਚੇ ਆ ਉਹ ਲਿਟਲ ਫਲਾਵਰ 'ਚ ਜਾਂਦੇ ਭੈਣ ਜੀ ਅੱਛਾ ਸਕੂਲ ਹੈ ਹਾਂ ਅੱਛਾ ਸਕੂਲ ਹੈ ਆਈ ਸੀ ਆਈ ਸੀ ਬੋਰਡ ਹੈ ਇੱਥੇ ਸਟਾਫ਼ ਜਿਹੜਾ ਆ ਉਹ ਵੈੱਲ ਕੁਆਲੀਫਾਈਡ ਹੈ ਕੋਪਰੇਟਿਵ ਹੈ ਔਰ ਜਿਹੜੀ ਸਟੱਡੀ ਹੈ ਉਹ ਵੀ ਬਹੁਤ ਵਧੀਆ ਹੁੰਦੀ ਹੈ ਇੰਗਲਿਸ਼ ਦੇ ਉੱਤੇ ਮਤਲਬ ਕਿ ਜੋ ਵੀ ਟੋਕਿੰਗ ਆ ਸਾਰੀ ਇੰਗਲਿਸ਼ ਦੇ ਵਿੱਚ ਹੀ ਹੁੰਦੀ ਹੈ ਹੈ ਨਾ ਅਤੇ ਸਟਾਫ਼ ਵਧੀਆ ਬਾਕੀ ਕਲਾਸਰੂਮ ਫੈਸਿਲਿਟੀਜ਼ ਵੀ ਵਧੀਆ ਬੱਚਿਆਂ ਨੂੰ ਵਧੀਆ ਤਰੀਕੇ ਨਾਲ ਪੜ੍ਹਾਉਂਦੇ ਹੈ ਟੀਚਰ ਕੋਆਪਰੇਟਿਵ ਹੈ ਜਿਹੜੀ ਨਿਊ ਟੈਕਨੀਕਸ ਦੇ ਅਕੋਡਿੰਗ ਡਿਜੀਟਲ ਬੋਰਡ ਦੇ ਉੱਤੇ ਜਿਹੜੀ ਬੱਚਿਆਂ ਨੂੰ ਸਟੱਡੀ ਹੈ ਨਾ ਉਹ ਕਰਵਾਈ ਜਾਂਦੀ ਹੈ ਹਾਂਜੀ ਇਹ ਅਜੇ ਟੈਂਨਥ ਤੱਕ ਹੀ ਹੈ ਇਹਨਾਂ ਨੂੰ ਐਫੀਲੇਸ਼ਨ ਵਗੈਰਾ ਸਭ ਮਿਲੀ ਹੋਈ ਹੈ ਆਈ ਸੀ ਐੱਸ ਈ ਬੋਰਡ ਦੀ ਨਾ ਅਤੇ ਬੱਚੇ ਗੁੜੀਆ ਇੱਕ ਟੈਂਨਥ ਵਿੱਚ ਹੈ ਅਤੇ ਦੂਸਰੀ ਏਟਥ ਵਿੱਚ ਹੈ ਹਾਂਜੀ ਹਾਂਜੀ ਹਾਂ ਕੋਈ ਗੱਲ ਨਹੀਂ ਬੇਝਿਜਕ ਹੋ ਕੇ ਪਾਓ ਤੁਸੀਂ ਹਾਂਜੀ ਹਾਂਜੀ ਚਲੋ ਹਾਂ ਠੀਕ ਹੈ ਠੀਕ ਹੈ ਹੋਰ ਕੋਈ ਇਨਫੋਰਮੇਸ਼ਨ ਚਾਹੀਦੀ ਤਾਂ ਦੱਸ ਦਿਓ ਕੋਈ ਗੱਲ ਨਹੀਂ ਠੀਕ ਹੈ ਜੀ ਓਕੇ ਓਕੇ